ਵੱਧ ਰਹੀ ਜਨਸੰਖਿਆ ਦਾ ਦੇ ਉੱਤੇ ਕੰਟਰੋਲ ਕਰਨਾ ਹੁਣ ਪਹਿਲਾਂ ਤਾਂ ਸਰਕਾਰ ਕਦਮ ਚੁੱਕਦੀ ਸੀ ਬਟ ਹੁਣ ਥੋੜ੍ਹਾ ਥੋੜ੍ਹਾ ਥੋੜ੍ਹਾ ਨਹੀਂ ਸੱਤਰ ਪ੍ਰਸੈਂਟ ਕਹਿ ਸਕਦੇ ਹਾਂ ਅਸੀਂ ਕਿ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਲੱਗ ਚੁੱਕਿਆ ਕਿ ਪੜ੍ਹਿਆ ਲਿਖਿਆ ਆਦਮੀ ਤਾਂ ਅੱਜ ਵੀ ਸਮਝਦਾ ਇਸ ਚੀਜ਼ ਨੂੰ ਬਟ ਥੋੜ੍ਹੀ ਸਾਡੀ ਕੰਟਰੀ ਦੇ ਵਿੱਚ ਅਨਪੜ੍ਹਤਾ ਹੋਣ ਕਰਕੇ ਲੋਕਾਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਹੈ ਪੜੇ ਲਿਖੇ ਗੋਰਮੈਂਟ ਸਾਡੀ ਕਰ ਰਹੀ ਏ ਕਿ ਪਰਿਵਾਰ ਨੂੰ ਨਿਯੰਤਰ ਰੱਖਣ ਲਈ ਬੜੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਛੋਟੇ ਪਰਿਵਾਰ ਬਾਰੇ ਦੱਸਿਆ ਜਾਂਦਾ ਹੈ ਉਹਨਾਂ ਨੂੰ ਦੱਸਿਆ ਸਹੂਲਤਾਂ ਕਾਫੀ ਮਿਲ ਜਾਂਦੀਆਂ ਨੇ ਕਿਉਂਕਿ ਉਚੇਚੇ ਪ੍ਰਬੰਧ ਹੋ ਜਾਂਦੇ ਨੇ ਔਰ ਇਸ ਲਈ ਜਾਗਰੂਕਤਾ ਦਿੱਤੀ ਜਾਂਦੀ ਹੈ ਉੱਚ ਸਿੱਖਿਆ ਦਾ ਪ੍ਰਬੰਧ ਕੀਤਾ ਜਾਂਦਾ ਹੈ ਉੱਚ ਸਿੱਖਿਆ ਦਿੱਤੀ ਜਾਂਦੀ ਹੈ ਔਰ ਉਹਦਾ ਕਾਫੀ ਲੋਕ ਲਾਭ ਲੈਂਦੇ ਨੇ ਰਹਿ ਗਈ ਗੱਲ ਸਰੋਤਾਂ ਦੇ ਉੱਤੇ ਕੀ ਨੁਕਸਾਨ ਹੈ ਦੇਖੋ ਜਿਉਂ ਜਿਉਂ ਆਬਾਦੀ ਵੱਧਦੀ ਹੈ ਤਿਉਂ ਤਿਉਂ ਸਰੋਤਾਂ ਦੀ ਵਰਤੋਂ ਜ਼ਿਆਦਾ ਹੁੰਦੀ ਆ ਔਰ ਉਹਨਾਂ 'ਚ ਕਮੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਿਵੇਂ ਪਹਿਲਾ ਸਰੋਤ ਤਾਂ ਪਾਣੀ ਹੀ ਲੈ ਲੈਂਦੇ ਆਂ ਇਨਸਾਨ ਨੂੰ ਪਤਾ ਹੋਣ ਦੇ ਬਾਵਜੂਦ ਵੀ ਕਿ ਪਾਣੀ ਉਸ ਲਈ ਬਹੁਤ ਜ਼ਰੂਰੀ ਹੈ ਫਿਰ ਵੀ ਅ ਆਬਾਦੀ ਵੀ ਵੱਧ ਰਹੀ ਹੈ ਅਤੇ ਉਸ ਨੂੰ ਗੰਧਲਾ ਵੀ ਕੀਤਾ ਜਾਂਦਾ ਹੈ ਟੂਣੇ ਟੱਪੇ ਕਰਕੇ ਦਰਿਆਵਾਂ ਦੇ ਵਿੱਚ ਗੰਦ ਪਾਇਆ ਜਾਂਦਾ ਹੈ ਗੰਦੀਆਂ ਕੈਮੀਕਲ ਦੀਆਂ ਫੈਕਟਰੀਆਂ ਨੂੰ ਦਰਿਆਵਾਂ ਦੇ ਵਿੱਚ ਮਿਕਸ ਕੀਤਾ ਜਾ ਰਿਹਾ ਹੈ ਇਹਨਾਂ ਚੀਜ਼ਾਂ ਦਾ ਉਹਦੇ ਉੱਤੇ ਬਹੁਤ ਅਸਰ ਪੈਂਦਾ ਹੈ ਉਸ ਤੋਂ ਬਾਅਦ ਫਿਰ ਅਗਰ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਲਈ ਸਾਡੇ ਦਰਖਤ ਸੌ ਪ੍ਰਰਸੈਂਟ ਹਿੱਸਾ ਨਿਭਾਉਂਦੇ ਜੇ ਤਾਂ ਅੱਜ ਜੰਗਲਾਂ ਦੀ ਕਟਾਈ ਵੀ ਕੀਤੀ ਜਾ ਰਹੀ ਹੈ ਜਿਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਲਿਊਸ਼ਨ ਹੋ ਰਿਹਾ ਹੈ ਮੌਸਮ ਦੇ ਵਿੱਚ ਕਾਫੀ ਫਰਕ ਪੈ ਜਾਂਦਾ ਹੈ ਜੇ ਗਰਮੀ ਪੈਂਦੀ ਤਾਂ ਪੂਰੀ ਗਰਮੀ ਪੈਂਦੀ ਹੈ ਸਾਹ ਵੀ ਨਹੀਂ ਲਿਆ ਜਾਂਦਾ ਅਤੇ ਜੇ ਠੰਡ ਪੈਂਦੀ ਹੈ ਤਾਂ ਠੰਡ ਵੀ ਬਹੁਤ ਪੈ ਜਾਂਦੀ ਹੈ ਬਟ ਇਹ ਚੀਜ਼ਾਂ ਘੱਟ ਚੁੱਕੀਆਂ ਨੇ ਆਬਾਦੀ ਵਧਣ ਨਾਲ ਪੋਲਿਊਸ਼ਨ ਵੱਧ ਵੱਧ ਗਿਆ ਹੈ ਬਹੁਤ ਜ਼ਿਆਦਾ ਅਤੇ ਉਪਜਾਊ ਮਿੱਟੀ ਦੀ ਵੀ ਬਹੁਤ ਕਮੀ ਹੋਣੀ ਸ਼ੁਰੂ ਹੋ ਗਈ ਕਿਉਂਕਿ ਜਗ੍ਹਾ ਜਗ੍ਹਾ ਦੇ ਉੱਤੇ ਗੰਦ ਸੁੱਟਿਆ ਜਾ ਰਿਹਾ ਪਲਿਊਸ਼ਨ ਵਧਣ ਨਾਲ ਸਾਡੇ ਘਰਾਂ ਦਾ ਕੂੜਾ ਇਹ ਡਸਟ ਬਹੁਤ ਜ਼ਿਆਦਾ ਵੱਧ ਗਿਆ ਹੈ ਉਹ ਜਗ੍ਹਾ ਜਗ੍ਹਾ ਖਿਲਾਰਿਆ ਜਾ ਰਿਹਾ ਹੈ ਸ ਅਸੀਂ ਗੌਰਮੈਂਟ ਨੂੰ ਸਲਾਹ ਦਿਆਂਗੇ ਕੋਈ ਵੀ ਸਟੇਟ ਗੌਰਮਿੰਟ ਹੈ ਉਹ ਜਿਹੜਾ ਨਿਕਲਿਆ ਹੋਇਆ ਘਰਾਂ ਦਾ ਨਿਕਲਿਆ ਹੋਇਆ ਕੂੜਾ ਕਰਕਟ ਉਹਨਾਂ ਨੂੰ ਖਤਮ ਕਰਨ ਲਈ ਉਹਨਾਂ ਨੂੰ ਜਜ਼ਬ ਕਰਨ ਲਈ ਉਹਨਾਂ ਦੀ ਖਾਦ ਬਣਾਈ ਜਾਏ ਜਾਂ ਔਰ ਲੋਕਾਂ ਨੂੰ ਜਾਗਰੂਕ ਕੀਤਾ ਜਾਏ ਕਿ ਗੰਦੇ ਪਾਣੀ ਦੇ ਵਿੱਚ ਘਰ ਦਾ ਕੂੜਾ ਜਾਂ ਟੂਣੇ ਟੱਪੇ ਕਰਨੇ ਗੈਰ ਕਾਨੂੰਨੀ ਹਨ ਇਹ ਇਹ ਸਖਤੀ ਨਾਲ ਕੋਈ ਨਾ ਕੋਈ ਇਹੋ ਜਿਹਾ ਕਾਨੂੰਨ ਬਣਾਇਆ ਜਾ ਲੋਕਾਂ ਨੂੰ ਸਖਤੀ ਨਾਲ ਇਸਦੇ ਆਦੇਸ਼ ਦਾ ਪਾਲਣ ਕਰਨਾ ਹੀ ਪਵੇ